ਪੰਜਾਬ ਦੇ ਵਿੱਚ ਸਾਡੇ ਸਿਹਤ ਨਾਲ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਬਿਮਾਰੀਆਂ ਹੋ ਰਹੀਆਂ ਸਾਨੂੰ ਅੱਜ ਕੱਲ੍ਹ ਹੈਲਥ ਕੇਅਰ ਫਾਇਨੈਂਸਿੰਗ ਮਿਲ ਰਹੀ ਹੈ ਜਿਵੇਂ ਕਿ ਬੀਮਾ ਸੁਵਿਧਾਵਾਂ ਹਨ ਇਹ ਮਿਲ ਰਹੀਆਂ ਆ ਸਾਨੂੰ ਉਹਦੇ ਨਾਲ ਇਹ ਫਾਇਦਾ ਹੋ ਜਾਂਦਾ ਕਿ ਅਗਰ ਅਸੀਂ ਬਿਮਾਰ ਹੁੰਦੇ ਹਾਂ ਅਸੀਂ ਅਗਰ ਪਹਿਲਾ ਬੀ ਪਹਿਲੇ ਪਹਿਲਾ ਬੀਮਾ ਕਰਵਾਇਆ ਹੋਵੇ ਅਤੇ ਸਾਨੂੰ ਉਸਦਾ ਕੇਅਰ ਨਹੀਂ ਕਰਨੀ ਪੈਂਦੀ ਹੈਗੀ ਕਿ ਸਾਨੂੰ ਪੈਸੇ ਕਿੱਥੋਂ ਆਉਣਗੇ ਅੱਜ ਕੱਲ੍ਹ ਜ ਇਸ ਤਰ੍ਹਾਂ ਦੀਆਂ ਬੀਮਾ ਕੰਪਨੀਆਂ ਆ ਜਿਹੜਾ ਸਾਲ ਦਾ ਤੀਹ ਹਜ਼ਾਰ ਰੁਪਈਆ ਇਕੱਠਾ ਹੀ ਲੈ ਲੈਂਦੀਆਂ ਅਤੇ ਜ ਤੁਸੀਂ ਪੰਜ ਸਾਲ ਜਾਂ ਦਸ ਸਾਲ ਉਹਨੂੰ ਪੇ ਕਰਨਾ ਹੁੰਦਾ ਆ ਅਗਰ ਤੁਸੀਂ ਦੋ ਸਾਲ ਜਾਂ ਤਿੰਨ ਸਾਲ ਬਾਅਦ ਬਿਮਾਰ ਹੋ ਜਾਂਦੇ ਆ ਅਤੇ ਉਹ ਸਾਰਾ ਖਰਚਾ ਬੀਮਾ ਕੰਪਨੀਆਂ ਹੀ ਚੱਕਦੀਆਂ ਆ ਅਤੇ ਇਸ ਕਰਕੇ ਸਾਨੂੰ ਜੇਬ ਤੋਂ ਬਾਹਰ ਖਰਚੇ ਇਸ ਤਰ੍ਹਾਂ ਦੇ ਹੁੰਦੇ ਆ ਇਹ ਸਾਡੀਆਂ ਬਿਮਾਰੀਆਂ ਜਿਹੜੀਆਂ ਇਹ ਜੇਬ ਤੋਂ ਬਾਹਰ ਖਰਚੇ ਕਰਦੀਆਂ ਹੈ ਇਸ ਲਈ ਸਾਨੂੰ ਬੀਮਾ ਕਰਵਾ ਲੈਣਾ ਚਾਹੀਦਾ ਆ